ਹੈਲੋ

ਤੁਹਾਡੀ ਆਵਾਜ਼ ਕਲੀਅਰ ਨਹੀਂ ਆਈ ਤੁਹਾਡੀ ਆਵਾਜ਼ ਪਿੱਛੇ ਥੋੜ੍ਹੀ ਜਿਹੀ ਹਵਾ ਜ਼ਿਆਦਾ ਆ ਰਹੀ ਹੈ ਥੋੜ੍ਹਾ ਤੁਸੀਂ ਆਪਣੀ ਵੋਇਸ ਨੂੰ ਕਲੀਅਰ ਕਰ ਲਓ

ਹਾਂਜੀ ਹਾਂਜੀ ਮੈਂ ਪਲੇਸਮੈਂਟ ਸੈੱਲ ਤੋਂ ਗੱਲ ਕਰਦੀ ਹਾਂ ਮੇਰਾ ਨਾਮ ਜੈਸਮੀਨ ਆ ਅਤੇ ਮੈਂ ਹੁਸ਼ਿਆਰਪੁਰ ਤੋਂ ਗੱਲ ਕਰ ਰਹੀ ਹਾਂ ਹਾਂਜੀ ਹਾਂਜੀ ਕਰੋ ਜੋਬ ਆਫਰ ਦੇ ਲਈ ਹੁਸ਼ਿਆਰਪੁਰ ਦੇ ਵਿੱਚ ਸਾਤੋਂ ਮਲ ਕਿ ਬਹੁਤ ਸਾਰੀ ਚੋਇਸਸ ਹੈ ਅਲੱਗ ਅਲੱਗ ਜਿੱਦਾਂ ਕਿ ਸੋਨਾਲੀਕਾ ਹੋ ਗਿਆ ਅਗਰ ਤੁਸੀਂ ਸੋਨਾਲੀਕਾ ਦਾ ਚਾਹੁੰਦੇ ਹੋ ਲੱਗਣਾ ਠੀਕ ਹੈ ਗ੍ਰੈਜੂਏਸ਼ਨ ਤਾਂ ਤੁਹਾਡੇ ਕੋਲ ਹੋਏਗੀ ਗ੍ਰੈਜੂਏਸ਼ਨ ਦੀ ਮਤਲਬ ਕਿ ਨੀਡ ਹੈ ਆਪਾਂ ਨੂੰ ਠੀਕ ਆ ਅਤੇ ਤੁਸੀਂ ਮਤਲਬ ਕਿ ਅਪਲਾਈ ਕਰ ਸਕਦੇ ਹੋ ਸੋਨਾਲੀਕਾ ਅਪਲਾਈ ਕਰ ਸਕਦੇ ਹੋ ਆਪਣਾ ਗਵਰਮੈਂਟ ਕੋਲਜ ਹੁਸ਼ਿਆਰਪੁਰ ਜਿਹੜਾ ਹੈਗਾ ਸਭ ਤੋਂ ਵਧੀਆ ਉੱਥੇ ਸਭ ਤੋਂ ਵਧੀਆ ਏਰੀਆ ਤੁਹਾਨੂੰ ਮਤਲਬ ਕਿ ਕਹਿੰਦੇ ਆ ਕਿ ਸਰਕਾਰੀ ਵਰਗੀ ਕੋਈ ਰੀਸ ਨਹੀਂ ਜੇ ਤੁਸੀਂ ਉੱਥੇ ਟਰਾਈ ਕਰੋ ਤਾਂ ਮਲ ਕਿ ਗੋਰਮੈਂਟ ਵਧੀਆ ਡੀ ਏ ਵੀ ਕੋਲਜ ਹੋ ਗਿਆ ਆਪਣਾ ਉੱਥੇ ਵੀ ਤੁਸੀਂ ਮਲ ਕਿ ਐਜ ਆ ਪ੍ਰੋਫੈਸਰ ਜੁਆਇਨ ਕਰ ਸਕਦੇ ਹੋ ਐਜ਼ ਏ ਟੀਚਰ ਨਿਊ ਜੁਆਇਨ ਕਰ ਸਕਦੇ ਹੋ ਠੀਕ ਹੈ ਐਜ਼ ਆ ਗਾਈਡ ਨਿਊ ਜੁਆਇਨ ਕਰ ਸਕਦੇ ਹੋ ਉਸ ਤੋਂ ਇਲਾਵਾ ਜਿਹੜੀ ਆਪਣੀ ਮਿੱਲ ਵਗੈਰਾ ਹੋਊਗੀ ਉੱਥੇ ਹੁਸ਼ਿਆਰਪੁਰ ਦੀਆਂ ਠੀਕ ਕੋਕੋ ਕੋਲਾ ਫੈਕਟਰੀ ਹੋ ਗਈ ਮਤਲਬ ਕਿ ਬਹੁਤ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਆਪਣੇ ਕੋਲ ਹੈਗੀਆਂ ਚੁਆਇਸਸ ਜਿੱਥੇ ਤੁਸੀਂ ਜੁਆਇਨ ਕਰ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਮਤਲਬ ਕਿ ਜਿਹੜੇ ਆਪਣੇ ਹੁੰਦੇ ਆ ਆਨਲਾਈਨ ਜਿਹੜੇ ਆਪਣੇ ਮਲ ਕਿ ਤੁਸੀਂ ਅਗਰ ਤੁਸੀਂ ਪ੍ਰਾਈਵੇਟ ਕਰਨਾ ਚਾਹੁੰਦੇ ਹੋ ਤਾਂ ਪ੍ਰਾਈਵੇਟ ਲਈ ਆਪਣੇ ਤੋਂ ਮਲ ਜਿਹੜੀ ਚੋਇਸਸ ਹੁੰਦੀਆਂ ਜਿੱਦਾਂ ਆਪਣੀ ਬਹੁਤ ਸਾਰੀ ਸ਼ੋਪਸ ਹੈਗੀਆਂ ਸੈਮਸੰਗ ਵੋਡਾਫੋਨ ਓਪੋ ਇਹਨਾਂ ਕੰਪਨੀ ਦੇ ਵਿੱਚ ਵੀ ਮਲ ਕਿ ਜਿਹੜੇ ਆਪਣੇ ਪਰਸਨ ਜਿੱਦਾਂ ਫਾਇਨਾਂਸ ਵਗੈਰਾ ਤੁਸੀੰ ਲੱਗ ਸਕਦੇ ਹੋ ਬੈਂਕ ਵੱਲੋਂ ਐਚ ਡੀ ਐਫ ਸੀ ਵੱਲੋਂ ਵਗੈਰਾ ਵੱਲੋਂ ਲੱਗ ਸਕਦੇ ਹੋ ਮਲ ਕਿ ਤੁਹਾਤੋ ਹੋਰ ਵੀ ਬੈਂਕ ਦੀ ਚੋਇਸਸ ਆ ਜਿੱਦਾਂ ਕਿ ਐਸ ਐਸ ਬੀ ਆਈ ਹੋ ਗਿਆ ਐਚ ਡੀ ਐ ਐਚ ਡੀ ਐਫ ਸੀ ਹੋ ਗਿਆ ਠੀਕ ਹੈ ਪੰਜਾਬ ਬੈਂਕ ਹੋ ਗਿਆ ਮਲ ਆਪਣੇ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਚੁਆਇਸਸ ਹੈ ਜਿੱਥੇ ਤੁਸੀਂ ਆਪਣਾ ਮਲ ਕਿ ਅਗਰ ਤੁਸੀਂ ਗੋਰਮੈਂਟ ਚਾਹੁੰਦੇ ਹੋ ਤਾਂ ਤੁਹਾਨੂੰ ਇਗਜਾਮ ਪਾਸ ਆਊਟ ਕਰਕੇ ਤੁਸੀਂ ਬਹੁਤ ਵੈਲ ਨ ਗੁਡ ਹੈ ਤੁਸੀਂ ਗੌਰਮੈਂਟ ਲੈ ਸਕਦੇ ਹੋ ਨਹੀਂ ਤਾਂ ਇਫ ਯੂ ਵਾਂਟ ਟੂ ਪ੍ਰਾਈਵੇਟ ਨ ਤੁਸੀਂ ਆਪਣਾ ਰਿਜ਼ਿਊਮ ਬਣਾਓ ਅਤੇ ਤੁਸੀਂ ਆ ਕੇ ਮਤਲਬ ਕਿ ਜੋਇਨ ਕਰ ਸਕਦੇ ਹੋ

ਹੈਲੋ ਹੈਲੋ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਉਹਨਾਂ ਦੀ ਫੈਸਿਲਿਟੀਸ ਬਹੁਤ ਅੱਛੀ ਹੈ ਮਲ ਕਿ ਸਟਾਰਟਿੰਗ ਸੈਲਰੀ ਜਿਵੇਂ ਕਿ ਤੁਹਾਨੂੰ ਪਤਾ ਕਿ ਘੱਟ ਹੀ ਹੁੰਦੀ ਆ ਹਮੇਸ਼ਾ ਉਹ ਤੋਂ ਬਾਅਦ ਥੋੜ੍ਹਾ ਮਲ ਕਿ ਉਹ ਤੋਂ ਬਾਅਦ ਡਬਲ ਕਰ ਦਿੰਦੇ ਨੇ ਟੂ ਥ੍ਰੀ ਈਅਰਸ ਬਾਅਦ ਅਤੇ ਵਧੀਆ ਪੈਕਜ ਆ ਅਗਰ ਤੁਸੀਂ ਚਾਹੋ ਤਾਂ ਮਲ ਕਿ ਜੁਆਇਨ ਕਰ ਸਕਦੇ ਹੋ ਉੱਥੇ ਫੈਸਿਲਿਟੀਜ ਵੀ ਨੇ ਉਹ ਪਰਸਨ ਉਹਨਾਂ ਲਈ ਕੀ ਉੱਥੇ ਮਲ ਕਿ ਰਹਿਣ ਵਾਸਤੇ ਵੀ ਮਲ ਕਿ ਥੋੜ੍ਹਾ ਪਲੇਸਮੈਂਟ ਵਗੈਰਾ ਕਰਦੇ ਨੇ ਵਧੀਆ ਦੱਸ ਦਿੰਦੇ ਨੇ ਮਲ ਕਿ ਅੱਛੀ ਹੈ ਅਗਰ ਤੁਸੀਂ ਸੋਨਾਲੀਕਾ ਜਾਣਾ ਚਾਹੁੰਦੇ ਹੋ ਤਾਂ

ਮਲ ਕਿ ਜਿਵੇਂ ਤੁਸੀਂ ਫਰੀਦਕੋਟ ਤੋਂ ਆ ਤਾਂ ਹੁਣ ਤੁਸੀਂ ਤੁਹਾਨੂੰ ਜੇ ਤੁਸੀਂ ਰੋਜ਼ ਆਉਣ ਜਾਣ ਵੀ ਕਰੋਗੇ ਤਾਂ ਤੁਹਾਨੂੰ ਮਲ ਕਿ ਫਾਈਵ ਐਂਡ ਹਾਫ ਹਾਂਜੀ ਹਾਂਜੀ ਪੇਇੰਗ ਗੈਸਟ ਲਓਗੇ ਤਾਂ ਮਲ ਕਿ ਤੁਸੀਂ ਸੋਨਾਲੀਕਾ ਦੇ ਨੀਅਰਬਾਏ ਵੀ ਲੈ ਸਕਦੇ ਹੋ ਜੇ ਉੱਧਰ ਤੁਹਾਨੂੰ ਏਰੀਆ ਨਹੀਂ ਪਸੰਦ ਆਉਂਦਾ ਤੁਸੀਂ ਮਲ ਕਿ ਆਪਣੇ ਮਲ ਕਿ ਬਾਏਪਾਸ ਤੋਂ ਇੱਧਰ ਨੂੰ ਜਦੋਂ ਆਪਾਂ ਆਉਂਦੇ ਹਾਂ ਆਪਣੇ ਦੀ ਸਾਈਡ ਤੁਸੀੰ ਇੱਧਰ ਕੋਈ ਜੁਆਇੰਨ ਕਰ ਸਕਦੇ ਹੋ ਕਾਫੀ ਪੀਜਿਜ ਵਗੈਰਾ ਨੇ ਰੈਂਟ ਹਾਉਸਿਸ ਵੀ ਤੁਸੀਂ ਉਹ ਜੁਆਇੰਨ ਮਲ ਕਿ ਲੈ ਸਕਦੇ ਹੋ ਪੇਮੈਂਟ ਦੇ ਨਾਲ ਤੁਹਾਨੂੰ ਸਹੀ ਮਲ ਕਿ ਅਮਾਊਂਟ ਦੇ ਵਿੱਚ ਤੁਹਾਨੂੰ ਮਿਲ ਜੂਗਾ ਸਹੀ ਰੈਂਟ 'ਤੇ ਮਤਲਬ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਚਾਹੁੰਦੇ ਹੋ ਉਸ ਤੋਂ ਇਲਾਵਾ ਬਾਕੀ ਤੁਸੀਂ ਮਲ ਕਿ ਅਗਰ ਗੌਰਮੈਂਟ ਵਗੈਰਾ ਵੀ ਕੋਲਜ ਵਗੈਰਾ ਵੀ ਜਾਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਬਸ ਇੱਕ ਇਗਜਾਮ ਆਪਣੀ ਇੱਕ ਪ੍ਰਸੈਂਟੇਜ ਵਗੈਰਾ ਤੁਹਾਡੀ ਹੋਣੀ ਚਾਹੀਦੀ ਹੈ ਕੋਲ ਅਤੇ ਇਗਜਾਮ ਪਾਸ ਆਊਟ ਕਰਨਾ ਅਤੇ ਉਹ ਤੋਂ ਬਾਅਦ ਤੁਸੀਂ ਕਰ ਸਕਦੇ ਹੋ ਹਾਂਜੀ ਵੈਲਕਮ ਜੀ